ਜੇਕਰ ਅਸੀਂ ਸਿੱਖਿਆ ਦੇ ਮਾਮਲੇ ਵਿੱਚ ਗੱਲ ਕਰੀਏ ਤਾਂ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਪਹਿਲਾਂ ਦੇ ਸਮੇਂ ਵਿੱਚ ਬਹੁਤ ਹੀ ਜ਼ਿਆਦਾ ਫ਼ਰਕ ਹੁੰਦਾ ਸੀਗਾ ਬਟ ਹੁਣ ਇਹ ਕਾਫ਼ੀ ਘੱਟ ਚੁੱਕਾ ਹੈ ਪੁਰਾਣੇ ਸਮੇਂ ਵਿੱਚ ਪਿੰਡ ਦੇ ਵਿੱਚ ਲੋਕਾਂ ਨੂੰ ਬਹੁਤ ਹੀ ਚੀਜ਼ਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਉਹਨਾਂ ਨੂੰ ਇੱਕ ਚੰਗੀ ਸਿੱਖਿਆ ਅਤੇ ਹੋਰ ਚੀਜ਼ਾਂ ਲਈ ਸ਼ਹਿਰ ਜਾਣਾ ਪੈਂਦਾ ਸੀਗਾ ਪਿੰਡਾਂ ਦੇ ਵਿੱਚ ਸਕੂਲ ਕੋਲੇਜ ਨਾ ਹੋਣ ਕਰਕੇ ਉਹਨਾਂ ਨੂੰ ਵਧੀਆ ਸਿੱਖਿਆ ਨਹੀਂ ਮਿਲ ਰਹੀ ਸੀ ਅਤੇ ਉਹਨਾਂ ਨੂੰ ਇੱਕ ਪਿਛੜਿਆ ਸਮਝਿਆ ਜਾਂਦਾ ਸੀਗਾ ਬਟ ਹੁਣ ਬਟ ਅੱਜ ਦੇ ਸਮੇਂ ਵਿੱਚ ਜੇਕਰ ਦੇਖਿਆ ਜਾਵੇ ਤਾਂ ਪਿੰਡਾਂ ਦੇ ਵਿੱਚ ਵੀ ਬਹੁਤ ਵਧੀਆ ਸਕੂਲ ਕੋਲੇਜ ਬਣ ਚੁੱਕੇ ਹਨ ਇੱਥੋਂ ਦੇ ਅਧਿਆਪਕ ਬਹੁਤ ਵਧੀਆ ਕਰ ਰਹੇ ਹਨ ਅਤੇ ਬੱਚੇ ਪੜ੍ਹ ਕੇ ਬ ਆਪਣੇ ਪੰਜਾਬ ਦਾ ਨਾਮ ਰੌਸ਼ਨ ਕਰ ਰਹੇ ਹਨ ਪਰ ਲੰਬੇ ਸਮੇਂ ਤੋਂ ਜੇਕਰ ਦੇਖਿਆ ਜਾਵੇ ਤਾਂ ਪੇਂਡੂ ਸਮਾਜ ਨੂੰ ਬਹੁਤ ਹੀ ਪਛੜਿਆ ਸਮਝਿਆ ਜਾਂਦਾ ਸੀਗਾ ਸ਼ਹਿਰ ਦੇ ਲੋਕ ਇਹਨਾਂ ਨੂੰ ਪਛੜੇ ਅਤੇ ਨਜ਼ਰਅੰਦਾਜ਼ ਕਰਦੇ ਸੀਗੇ ਪਰ ਹੁਣ ਇਹਨਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਹ ਸ਼ਹਿਰ ਦੇ ਮੁਕਾਬਲੇ ਵਧੀਆ ਸਿੱਖਿਆ ਪ੍ਰਾਪਤ ਕਰਕੇ ਵਧੀਆ ਅਹੁਦਿਆਂ 'ਤੇ ਕੰਮ ਕਰ ਰਹੇ ਹਨ